ਸਤਿ ਸ਼੍ਰੀ ਅਕਾਲ ਮੇਰਾ ਨਾਮ ਵਾਸੁਦਾ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਅੱਜ ਮੇਰਾ ਗੌਰਮੈਂਟ ਨੌਕਰੀ ਲਈ ਪੇਪਰ ਸੀ ਜੋ ਕਿ ਮੈਨੂੰ ਪਠਾ ਜਲੰਧਰ ਵਿੱਚ ਜਾ ਕੇ ਦੇਣਾ ਸੀ ਅਤੇ ਮੈਂ ਉਸ ਲਈ ਕੈਬ ਬੁੱਕ ਕਰਵਾਈ ਸੀ ਪਰ ਉਹ ਕੈਬ ਮੈਂ ਕੱਲ੍ਹ ਦੀ ਬੁੱਕ ਕਰਵਾਈ ਹੋਈ ਸੀ ਅਤੇ ਮੈਂ ਉਸ ਦੀ ਪੇਮੈਂਟ ਵੀ ਕਰ ਚੁੱਕੀ ਹਾਂ ਪਰ ਹੁਣ ਮੈਂ ਇੱਥੇ ਖੜ੍ਹੀ ਹਾਂ ਮੈਂ ਵੇਟ ਕਰੀ ਜਾ ਰਹੀ ਹਾਂ ਪਰ ਕੈਬ ਵਾਲਾ ਹਜੇ ਤੱਕ ਨਹੀਂ ਆਇਆ ਮੈਂ ਉਸਨੂੰ ਕਈ ਵਾਰ ਫੋਨ ਵੀ ਕੀਤਾ ਹੈ ਪਰ ਉਹ ਬਾਰ ਬਾਰ ਬਹਾਨੇ ਲਗਾ ਰਿਹਾ ਹੈ ਕਿ ਮੈਂ ਪੰਜ ਪੰਜ ਪੰਜ ਮਿੰਟ ਤੱਕਰ ਆ ਜਾਂਦਾ ਹਾਂ ਪਰ ਮੈਂ ਬਹੁਤ ਜ਼ਿਆਦਾ ਲੇਟ ਹੋ ਚੁੱਕੀ ਹਾਂ ਅਤੇ ਮੇਰਾ ਪੇਪਰ ਵੀ ਬਹੁਤ ਜ਼ਰੂਰੀ ਹੈ ਉਸ ਲਈ ਮੈਂ ਬਹੁਤ ਮਿਹਨਤ ਕੀਤੀ ਹੋਈ ਹੈ ਅੱਗੇ ਹੀ ਮੈਂ ਇੱਕ ਘੰਟਾ ਲੇਟ ਹੋ ਚੁੱਕੀ ਹਾਂ ਅਤੇ ਕਿਰਪਾ ਕਰਕੇ ਜਾਂ ਤਾਂ ਮੇਰੇ ਪੈਸੇ ਰਿਫੰਡ ਕਰ ਦਿੱਤੇ ਜਾਣ ਜਿਸ ਰਾਹੀਂ ਮੈਂ ਕਿਤੇ ਹੋਰ ਜ਼ਰੀਏ ਇੱਥੋਂ ਜਾਵਾਂ